ਖੇਤੀ ਬਹੁਤ ਹੀ ਸਾਰੀਆਂ ਨਵੀਆਂ ਤਕਨੀਕਾਂ ਖੇਤੀ ਕਰਨ ਦੇ ਢੰਗ ਸਰਕਾਰ ਨੇ ਪੁਰਾਣੇ ਢੰਗਾਂ ਨੂੰ ਬਦਲ ਕੇ ਨਵੇਂ ਤਰੀਕੇ ਨਾਲ ਫਸਲ ਕਰਨ ਦੀ ਜਾਣਕਾਰੀ ਦਿੱਤੀ ਹੈ ਦੇ ਨਾਲ ਹੀ ਸਾਡੀ ਫਸਲ ਵਧੀਆ ਹੋਵੇਗੀ ਕਿ ਕਿਹੜੀਆਂ ਕਿਹੜੀਆਂ ਖਾਦਾਂ ਜਿਸ ਨਾਲ ਫਸਲ ਦਾ ਝਾੜ ਵਧੀਆ ਹੋਏਗਾ ਅੱਜ ਕੱਲ੍ਹ ਨਵੇਂ ਨਵੇਂ ਸੰਦ ਅਤੇ ਨਵੇਂ ਔਜ਼ਾਰ ਆ ਚੁੱਕੇ ਹਨ ਜਿਸ ਨਾਲ ਫਸਲ ਜ਼ਮੀਨ ਦੀ ਸਿੰਚਾਈ ਅਤੇ ਫਸਲ ਦੀ ਬਿਜਾਈ ਫਸਲ ਦੀ ਕਟਾਈ ਉੱਤੇ ਵੱਖਰੇ ਵੱਖਰੇ ਔਜ਼ਾਰ ਹਨ ਇਹ ਔਜ਼ਾਰ ਸਰਕਾਰ ਨੇ ਖੇਤੀਬਾੜੀ ਦੇ ਨੂੰ ਨਵੇਂ ਤਰੀਕੇ ਨਾਲ ਅਤੇ ਘੱਟ ਸਮੇਂ ਵਿੱਚ ਕੰਮ ਕਰਨ ਵਾਲੇ ਔਜ਼ਾਰ ਬਣਾਏ ਹਨ ਇਹਨਾਂ ਸੰਦਾਂ ਜਾਂ ਮਸ਼ੀਨਾਂ ਦੀ ਜਾਣਕਾਰੀ ਲਈ ਸਾਨੂੰ ਕਈ ਸਰੋਤਿਆਂ ਦੀ ਮਲ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਅਖਬਾਰਾਂ ਟੈਲੀਵਿਜ਼ਨ ਸਮਾਰਟਫੋਨ ਕਿਸਾਨੀ ਮੇਲੇ ਆਦਿ ਇਹਨਾਂ ਰਾਹੀਂ ਸਾਨੂੰ ਨਵਿਆਂ ਢੰਗਾਂ ਅਤੇ ਤਕਨੀਕਾਂ ਦੀ ਵਰਤੋਂ ਬਾਰੇ ਦੱਸਿਆ ਜਾਂਦਾ ਹੈ